ਬਾਏ ਪ੍ਰੋਫੈਸ਼ਨ ਮੈਂ ਇੱਕ ਜੋਗ੍ਰਾਫਰ ਹਾਂ ਔਰ ਮੈਨੂੰ ਚੀਜ਼ਾਂ ਨੂੰ ਔਬਜਰਵ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਘੁੁੰਮਣਾ ਉੱਥੋਂ ਦੇ ਮਾਊਂਟੇਨਸ ਹੋ ਗਏ ਉੱਥੋਂ ਦਾ ਰਿਲੀਫ ਹੋ ਗਿਆ ਕਲਾਈਮੇਟ ਹੋ ਗਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਉਹਨਾਂ ਨੂੰ ਔਬਜਰਵ ਕਰਨਾ ਉਹਨਾਂ ਬਾਰੇ ਫਿਰ ਰਿਸਰਚ ਕਰਨਾ ਮੈਨੂੰ ਬੜਾ ਅੱਛਾ ਲੱਗਦਾ ਹੈ ਸੋ ਮੈਂ ਜਦੋਂ ਵੀ ਕਿਸੇ ਵੀ ਏਰੀਆ 'ਚ ਜਾਂਦੀ ਹਾਂ ਸਭ ਤੋਂ ਪਹਿਲਾਂ ਮੈਂ ਉਸ ਏਰੀਆ ਦੀ ਪੂਰੀ ਇਨਫੋਰਮੇਸ਼ਨ ਲੈਂਦੀ ਹੈ ਕਿ ਉੱਥੇ ਕਿਵੇਂ ਦਾ ਕਲਾਇਮੈਂਟ ਹੈ ਕਿਹੜੀ ਕਿਹੜੀਆਂ ਚੀਜ਼ਾਂ ਦੀ ਮੈਨੂੰ ਉੱਥੇ ਜਾ ਕੇ ਲੋੜ ਪਵੇਗੀ ਔਰ ਜਿਸ ਰਸਤੇ ਰਾਹੀ ਮੈਂ ਜਾਣਾ ਹੈ ਅਗਰ ਮੈਂ ਬਾਏ ਟ੍ਰੇਨ ਜਾ ਰਹੀ ਹਾਂ ਤਾਂ ਮੈਨੂੰ ਬਾਏ ਟ੍ਰੇਨ ਕਿਨਹਾ ਕਿਨਹਾ ਚੀਜ਼ਾਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਸਮ ਟਾਈਮਸ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਅਗਰ ਆਪਾਂ ਜੰਮੂ ਕਸ਼ਮੀਰ ਜਾ ਰਹੇ ਹਾਂ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਗਰਮੀ ਹੁੰਦੀ ਹੈ ਬਟ ਉੱਧਰ ਜਾ ਕੇ ਠੰਡ ਹੋ ਜਾਂਦੀ ਹੈ ਔਰ ਰਸਤੇ ਦੇ ਵਿੱਚ ਵੀ ਠੰਡ ਹੁੰਦੀ ਹੈ ਸੋ ਮੈਂ ਇਹਨਾਂ ਸਾਰੀਆਂ ਚੀਜ਼ਾ ਦਾ ਧਿਆਨ ਰੱਖਦੀ ਹਾਂ ਕਿ ਜੋ ਮੇਰੀ ਜਰਨੀ ਦਾ ਇੱਕ ਰਸਤਾ ਹੈ ਇੱਕ ਵੇਅ ਹੈ ਉਹਦੇ ਵਿੱਚ ਮੈਨੂੰ ਕਿਨਹਾ ਕਿਨਹਾ ਚੀਜ਼ਾਂ ਦੀ ਲੋੜ ਪਵੇਗੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਅਰੇਂਜ ਕਰਦੀ ਹਾਂ ਉਸ ਤੋਂ ਬਾਅਦ ਮੈਂ ਹਮੇਸ਼ਾ ਹੀ ਆਪਣਾ ਜੋ ਕਨਵੀਨੈਂਸ ਹੈ ਉਹ ਕੰਫਰਟੇਬਲ ਚੂਜ਼ ਕਰਦੀ ਹਾਂ ਅਗਰ ਲੋਂਗ ਡਿਸਟੈਂਸ ਹੈ ਬਹੁਤ ਜ਼ਿਆਦਾ ਲੰਬਾ ਸਫਰ ਕਰਨਾ ਹੈ ਤਾਂ ਮੈਂ ਹਮੇਸ਼ਾਂ ਰੇਲਵੇ ਜਾਂ ਏਅਰ ਪਲੇਨ ਹੀ ਚੂਜ਼ ਕਰਦੀ ਹਾਂ ਬਟ ਅਗਰ ਕੋਈ ਸ਼ੋਟ ਡਿਸਟੈਂਸ ਹੈ ਤਾਂ ਮੈਂ ਮੋਸਟਲੀ ਕੀ ਹੈ ਕੈਬ ਜਾਂ ਫਿਰ ਖੁਦ ਕਾਰ ਡਰਾਈਵ ਕਰਕੇ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਅਗਰ ਤੁਸੀਂ ਬੜੇ ਆਰਾਮਦਾਇਕ ਢੰਗ ਦੇ ਨਾਲ ਆਪਣੇ ਡੈਸਟੀਨੇਸ਼ਨ 'ਤੇ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਪ੍ਰੋਪਰ ਔਬਜਰਵ ਕਰ ਸਕਦੇ ਹੋ ਚੀਜ਼ਾਂ ਨੂੰ ਅਤੇ ਉਹਨਾਂ ਬਾਰੇ ਰਿਸਰਚ ਕਰ ਸਕਦੇ ਹੋ ਅਤੇ ਆਪਣੇ ਵਿਊਜ਼ ਦੇ ਸਕਦੇ ਹੋ ਜੋ ਕਿ ਬਾਕੀ ਲੋਕਾਂ ਨੂੰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਹੈਲਪਫੁੱਲ ਹੋਣਗੇ ਸੋ ਇਹਨਾਂ ਚੀਜ਼ਾਂ ਦਾ ਮੈਂ ਖਾਸ ਧਿਆਨ ਰੱਖਦੀ ਹਾਂ